ਮੈਂ ਮੂਰਤੀ ਕਲਾ ਨਾਲੋਂ ਬਾਕੀ ਕਲਾਵਾਂ ਵਿੱਚ ਜ਼ਿਆਦਾ ਮੁਹਾਰਤ ਰੱਖਦੀ ਹਾਂ ਅਤੇ ਕਲਾ ਸਾਡੀ ਜ਼ਿੰਦਗੀ ਦਾ ਬਹੁਤ ਹਿੱਸਾ ਹੈ ਲੋਕ ਅਲੱਗ ਅਲੱਗ ਤਰੀਕੇ ਨਾਲ ਇਸ ਵਿੱਚ ਪ੍ਰਸਿੱਧੀ ਪਾ ਰਹੇ ਹਨ ਕੋਈ ਅਲੱਗ ਅਲੱਗ ਤਰ੍ਹਾਂ ਦੀਆਂ ਪੇਂਟਿੰਗਸ ਬਣਾ ਕੇ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਮੂਰਤੀਆਂ ਮੈਂ ਮੂਰਤੀ ਕਲਾ ਤਾਂ ਸ਼ੁਰੂ ਤੋਂ ਨਹੀਂ ਕੀਤੀ ਪਰ ਪਰ ਮੈਂ ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਇੱਕ ਮੋਹਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਸਾਡੇ ਯੂਥ ਫੈਸਟੀਵਲ ਦਾ ਹਿੱਸਾ ਸੀ ਅਤੇ ਸਾਡੇ ਸਾਰੇ ਕੋਲਜ ਨੂੰ ਇਸ ਵਿੱਚ ਪਾਰਟੀਸਪੇਟ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਜੋ ਕਿ ਸਾਡੇ ਕੋਲਜ ਦੇ ਗਰਾਉਂਡ ਵਿੱਚ ਸੀ ਅਤੇ ਅਲੱਗ ਅਲੱਗ ਤਰ੍ਹਾਂ ਦੇ ਸਟੂਡੈਂਟਸ ਉੱਥੇ ਇਸ ਨੂੰ ਦੇਖਣ ਲਈ ਇਕੱਠੇ ਹੋਏ ਸਨ ਅਤੇ ਮੌਸਮ ਸਾਨੂੰ ਇਸ ਦੌਰਾਨ ਬਹੁਤ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਤਾਂ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਰੰਗਾ ਰੰਗਾਂ ਦੀ ਲੋੜ ਸੀ ਅਤੇ ਜੋ ਕਿ ਉਸ ਦੇ ਕੁਦਰਤੀ ਰੰਗਾਂ ਦੇ ਨਾਲ ਮੈਚ ਕਰਨੇ ਚਾਹੀਦੇ ਸਨ ਅਤੇ ਦੂਜਾ ਮੌਸਮ ਖਰਾਬ ਹੋਣ ਕਾਰਨ ਇੱਥੇ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਸਨ ਜਿਸ ਕਾਰਨ ਸਾਡੇ ਰੰਗ ਉੜ ਰਹੇ ਸਨ